ਪੰਜਾਬ ਦਾ ਕੁਦਰਤੀ ਲੈਂਡਸਕੇਪ ਇਹ ਐਂ ਵੱਖਰਾ ਕਿ ਇੱਥੇ ਹਰਾ ਮੈਦਾਨੀ ਇਲਾਕਾ ਹੈ ਅਤੇ ਖੇਤੀ ਵਧੀਆ ਹੁੰਦੀ ਹੈ ਅਤੇ ਕੁਝ ਏਰੀਆ ਹਿਮਾਚਲ ਦੇ ਨਾਲ ਲੱਗਦਾ ਜੋ ਕਿ ਪਹਾੜਾਂ ਦੀ ਦਿੱਖ ਦਿਸਦੀ ਹੈ ਇਸ ਕਰਕੇ ਇੱਥੇ ਕੁਦਰਤੀ ਝਰਨੇ ਹਨ ਪਹਾੜ ਨਗੇ ਬਾਰਿਸ਼ ਵਗੈਰਾ ਬਹੁਤ ਹੁੰਦੀ ਹੈ ਇਸ ਕਰਕੇ ਦੂਜੀਆਂ ਲੈਂਡਸਕੇਪ ਨਾਲੋਂ ਇਹ ਪੰਜਾਬ ਦਾ ਜਿਹੜਾ ਇਹ ਵੱਖਰਾ ਹੈ